ਟੈਕਨੋਲੋਜੀ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਅੱਜ ਕੱਲ੍ਹ ਵੱਖ ਵੱਖ ਨੌਕਰੀਆਂ ਦੇ ਵਿੱਚ ਟੈਕਨੋਲੋਜੀ ਜਿਵੇਂ ਕਿ ਅੱਜ ਕੱਲ੍ਹ ਖੇਤਾਂ ਦੇ ਵਿੱਚ ਟੈਕਨੋਲੋਜੀ ਦਾ ਬਹੁਤ ਹੀ ਵੱਡਾ ਰੋਲ ਹੈਗਾ ਟੈਕਨੋਲੋਜੀ ਦੇ ਨਾਲ ਕੰਮ ਬਹੁਤ ਸੌਖਾ ਹੋ ਗਿਆ ਹੈ ਜਿਵੇਂ ਕਿ ਪੈਸਟੀਸਾਈਡਸ ਨਾਲ ਅਤੇ ਮਸ਼ੀਨਾਂ ਨਾਲ ਮਸ਼ੀਨਾਂ ਨਾਲ ਬਹੁਤ ਹੀ ਜਲਦੀ ਫ਼ਸਲ ਕੱਟੀ ਜਾਂਦੀ ਹੈ ਕੰਬਾਈਨਾਂ ਨਾਲ ਬਹੁਤ ਹੀ ਜਲਦੀ ਕਣਕ ਵੱਢੀ ਜਾਂਦੀ ਹੈ ਅਤੇ ਬਹੁਤ ਹੀ ਸੌਖਾ ਕੰਮ ਹੋ ਗਿਆ ਹੈ ਪਹਿਲਾਂ ਲੋਕਾਂ ਨੂੰ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਸੀਗੇ ਪਰ ਅੱਜ ਕੱਲ੍ਹ ਬਹੁਤ ਹੀ ਆਸਾਨੀ ਨਾਲ ਇਹ ਕੰਮ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਹੋਰ ਵੀ ਟ ਟੈਕਨੋਲੋਜੀ ਕਰਕੇ ਨੌਕਰੀਆਂ ਮਿਲੀਆਂ ਹਨ ਜਿਵੇਂ ਕਿ ਏ ਆਈ ਵਜੋਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਨੌਕਰੀਆਂ ਮਿਲੀਆਂ ਹਨ ਅਤੇ ਵਿਦਿਆਰਥੀਆਂ ਨੂੰ ਅੱਜ ਕੱਲ੍ਹ ਟੈਕਨੋਲੋਜੀ ਦੇ ਰਿਲੇਟਡ ਨੌਕਰੀਆਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ ਜਿਵੇਂ ਕਿ ਕੰਪਿਊਟਰ ਟੈਕਨੋਲੋਜੀ ਡਿਗਰੀ ਉਹਨਾਂ ਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ ਇਹ ਬਹੁਤ ਹੀ ਫਾਇਦੇਮੰਦ ਹੋਣ ਨਾਲ ਹੀ ਉਹਨਾਂ ਨੂੰ ਅੱਗੇ ਜਾ ਕੇ ਇਸ ਦੇ ਰਿਲੇਟਿਡ ਬਹੁਤ ਵਧੀਆ ਨੌਕਰੀ ਮਿਲ ਸਕਦੀ ਹੈ ਜੀ